ਜਦੋਂ ਕਿ ਅਸੀਂ ਬਾਹਰ ਜਾਂਦੇ ਹਾਂ ਅਤੇ ਖਰਵ ਸਾਡੇ ਪੜੋਸੀਆਂ ਨੂੰ ਅਸੀਂ ਇਹਦੀ ਦੇਖ ਭਾਲ ਕਰਨ ਵਾਸਤੇ ਕਹਿ ਕੇ ਜਾਂਦੇ ਹਾਂ ਕਿਉਂਕਿ ਸਮੇਂ ਸਮੇਂ ਸਿਰ ਪੌਦਿਆਂ ਨੂੰ ਪਾਣੀ ਵੀ ਦਿੰਦੇ ਨੇ ਉਹਨਾਂ ਦੀ ਦੇਖਭਾਲ ਵੀ ਕਰਦੇ ਨੇ ਉਹਨਾਂ ਨਾਲ ਦੇਖ ਰੇਖ ਟੈਮ ਟੈਮ 'ਤੇ ਪਾਣੀ ਟੈਮ ਟੈਮ 'ਤੇ ਛਾਂ ਉਹਨਾਂ ਨੂੰ ਛਾਂ ਕਰਦੇ ਹੈ ਛਾਂ ਕਰਕੇ ਉਹਨਾਂ ਦੇ ਟੈਮ ਟੈਮ ਸਿਰ 'ਤੇ ਸੰਭਾਲ ਵੀ ਕਰਦੇ ਹੈ ਜੇਕਰ ਅਸੀਂ ਵੀ ਕਿਸੇ ਨੂੰ ਜ਼ਿੰਮੇਵਾਰੀ ਨਾ ਦੇ ਕੇ ਜਾਈਏ ਕਿ ਉਹ ਤਾਂ ਵਿਚਾਰੇ ਛਾਂ ਧੁੱਪੇ ਵੀ ਮੱਚ ਸੜ ਜਾਣ ਇਸ ਕਾਰਨ ਅਸਾਂ ਦੇ ਗੁਆਂਢੀ ਹੀ ਉਹਨਾਂ ਦੀ ਦੇਖਭਾਲ ਕਰਦੇ ਹਨ ਟੈਮ ਟੈਮ 'ਤੇ ਸਾਰਾ ਕੁਛ ਉਹਨਾਂ ਨੂੰ ਸੰਭਾਲਦੇ ਨੇ ਅਤੇ ਪੌਦਿਆਂ ਨੂੰ ਵੀ ਬਹੁਤ ਪਿਆਰ ਨਾਲ ਰੱਖਦੇ ਨੇ ਟੈਮ ਸਮੇਂ ਸਮੇਂ ਸਿਰ ਉਹਨਾਂ ਨੂੰ ਛਾਂ ਕਰਦੇ ਹੈ ਛਾਵੇਂ ਕਰਦੇ ਹੈ ਟੈਮ ਸਿਰ ਪਾਣੀ ਦਿੰਦੇ ਹੈ ਟੈਮ ਸਿਰ ਉਹਨੂੰ ਖਾਦ ਦਿੰਦੇ ਹੈ ਉਹਦੀ ਗੋਡੀ ਹੈ ਜੋ ਵੀ ਵਗੈਰਾ ਵਗੈਰਾ ਵੀ ਉਹਨਾਂ ਨੂੰ ਜ਼ਰੂਰਤ ਹੈ ਅਤੇ ਉਹਨਾਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਸੰਭਾਲਦੇ ਨੇ ਇਸ ਕਰਕੇ ਅਸੀਂ ਪੌਦਿਆਂ ਨਾਲ ਬਹੁਤ ਹੀ ਜ਼ਿਆਦਾ ਵੀ ਦੇਖਭਾਲ ਕਰਕੇ ਉਹਨਾਂ ਨੂੰ ਸਾਨੂੰ ਆਪ ਆਪਣੇ ਬੱਚਿਆਂ ਵਾਂਗ ਪੌਦਿਆਂ ਦੀ ਦੇਖਭਾਲ ਕਰਦੇ ਹਾਂ ਅਤੇ ਸੋ ਸਾਨੂੰ ਬਹੁਤ ਹੀ ਸੋਹਣੇ ਅਤੇ ਪਿਆਰੇ ਬੱਚਿਆਂ ਤੋਂ ਵੱਧ ਇਹ ਲੱਗਦੇ ਨੇ ਅਤੇ ਇਹਨਾਂ ਨੂੰ ਬੱਚਿਆਂ ਵਾਂਗ ਹੀ ਅਸੀਂ ਪੌਦਿਆਂ ਨੂੰ ਸੰਭਾਲਦੇ ਹਾਂ ਇਸ ਕਾਰਨ ਵੀ ਸਾਨੂੰ ਪੌਦਿਆਂ ਨਾਲ ਬਹੁਤ ਹੀ ਪਿਆਰ ਹੈ